ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਜੀ ਜੀ ਠੀਕ ਠੀਕ ਹੈ ਠੀਕ ਹੈ ਜੀ ਇਹ ਐਦਾਂ ਨਾ ਜੀ ਹੁਣ ਪਹਿਲਾਂ ਤਾਂ ਨਵਾਂ ਸਾਲ ਆਉਣ ਵਾਲਾ ਜੀ ਇਹ ਦਸੰਬਰ ਤੋਂ ਹੋ ਜਾਣਾ ਜੀ ਪਹਿਲਾਂ ਤਾਂ ਸ਼ੁਰੂ ਜੀ ਪੱਚੀ ਦਸੰਬਰ ਤੋਂ ਕ੍ਰਿਸਮਿਸ ਦਾ ਜੀ ਉਹ ਤੋਂ ਬਾਅਦ ਫਿਰ ਗਾਹਾ ਚਲੇ ਜਾਣਾ ਜੀ ਨਵੇਂ ਸਾਲ ਦਾ ਮਨਾਇਆ ਜਾਣਾ ਜੀ ਫਿਰ ਆਪਣੇ ਸਾਰਾ ਜਿਹੜਾ ਮਸ਼ਹੂਰ ਆ ਪੂਰਾ ਲੋਹੜੀ ਦਾ ਤਿਉਹਾਰ ਆ ਜਾਣਾ ਜੀ ਉਹਦੇ ਵਿੱਚ ਬੱਚੇ ਲੋਹੜੀਆਂ ਮੰਗਦੇ ਆ ਜਿਹਨਾਂ ਦੇ ਘਰੇ ਨਵੇਂ ਬੱਚੇ ਪੈਂਦਾ ਹੋਏ ਹੁੰਦੇ ਉਹਨਾਂ ਦੇ ਘਰ ਜਾਂਦੇ ਆ ਖੁਸ਼ੀਆਂ ਖੇੜੇ ਮਨਾਉਂਦੇ ਆ ਬੜੀ ਖੁਸ਼ੀ ਚਾਵਾਂ ਨਾਲ਼ ਮਨਾਇਆ ਜਾਂਦਾ ਜੀ ਢੋਲ ਵੱਜਦੇ ਆ ਬੋਲੀਆਂ ਪੈਂਦੀਆਂ ਭੰਗੜੇ ਪੈਂਦੇ ਆ ਅਤੇ ਉਹ ਤੋਂ ਬਾਅਦ ਫਿਰ ਆ ਜਾਂਦਾ ਜੀ ਵਿਸਾਖੀ ਦਾ ਤਿਉਹਾਰ ਜੀ ਵਿਸਾਖੀ ਫਿਰ ਇੱਦਾਂ ਜੀ ਸਾਡੇ ਕਈਆਂ ਕੰਮਾਂ ਨਾਲ਼ ਜੁੜੀ ਹੋਈ ਆ ਸਭ ਤੋਂ ਪਹਿਲਾਂ ਤਾਂ ਜੀ ਕਣਕ ਦੀ ਜਿਹੜੀ ਵਾਢੀ ਹੁੰਦੀ ਆ ਇਹ ਦੀ ਸ਼ੁਰੂਆਤ ਹੋ ਜਾਂਦੀ ਆ ਜੀ ਅਪ੍ਰੈਲ ਮਹੀਨੇ 'ਚ ਤੇਰ੍ਹਾਂ ਅਪ੍ਰੈਲ ਤੋਂ ਮਨਾਈ ਜਾਂਦੀ ਜੀ ਫਿਰ ਇਹਦੇ ਨਾਲ਼ ਇਹ ਸਬੰਧ ਜੁੜ ਜਾਂਦਾ ਜੀ ਅਨੰਦਪੁਰ ਸਾਹਿਬ ਦਾ ਜੀ ਗੁਰੂ ਸਾਹਿਬ ਨੇ ਵਿਸਾਖੀ ਵਾਲੇ ਦਿਨ ਪੰਜ ਪਿਆਰੇ ਸਾਜੇ ਸੀਗੇ ਹਾਂਜੀ ਠੀਕ ਹੈ ਜੀ ਉਹ ਤੋਂ ਬਾਅਦ ਫਿਰ ਗਾਹਾ ਆ ਜਾਂਦੇ ਜੀ ਤਿਉਹਾਰ ਰੱਖੜੀਆਂ ਦੇ ਆ ਜਾਂਦੇ ਜੀ ਵਰਤਾਂ ਦੇ ਆ ਜਾਂਦੇ ਜੀ ਫਿਰ ਗਾਹਾ ਦੁਸਹਿਰਾ ਆ ਗਿਆ ਜੀ ਦੁਸਹਿਰਾ ਦੇਖਲੋ ਫਿਰ ਆਲ਼ੇ ਦੁਆਲ਼ੇ ਆਪਣੇ ਕਿੱਦਾਂ ਵਧੀਆ ਵੱਖ ਵੱਖ ਥਾਵਾਂ ਮਨਾਇਆ ਜਾਂਦਾ ਜੀ ਹਾਂਜੀ ਹਾਂਜੀ ਬੁਰਾਈ ਦੀ ਜਿਹੜੀ ਅੱਛਾਈ 'ਤੇ ਜਿੱਤ ਹੈ ਉਹ ਇੱਥੇ ਮਨਾਇਆ ਜਾਂਦੀ ਜੀ ਆਈ ਟੀ ਆਈ ਗਰਾਊਂਡ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ਼ ਮਨਾਉਂਦੇ ਆ ਜੀ ਉਹ ਤੋਂ ਫਿਰ ਵੀਹ ਦਿਨ ਬਾਅਦ 'ਚ ਦਿਵਾਲੀ ਆ ਜਾਂਦੀ ਹੈ ਜੀ ਦਿਵਾਲੀ ਤਾ ਫਿਰ ਤੁਸੀਂ ਹੁਣ ਪਟਾਕੇ ਚਲਾ ਕੇ ਦੇਖ ਹੀ ਰਹੇ ਬਥੇਰੇ ਪਟਾਕੇ ਚਲਾਏ ਹੋਣੇ ਖੜਕਾ ਬਹੁਤ ਹੁੰਦਾ ਥੋੜਾ ਜਿਹਾ ਘੱਟ ਵਰਤਿਆ ਕਰੋ ਪ੍ਰਦੂਸ਼ਣ ਬਹੁਤ ਫ਼ੈਲ ਰਿਹਾ ਇਹਦੇ ਨਾਲ਼ ਹਾਂਜੀ ਹਾਂਜੀ ਮਨਾਉਣੇ ਤਾਂ ਤਿਉਹਾਰ ਤਾਂ ਮਨਾਉਣੇ ਚਾਹੀਦੇ ਪਰ ਜਿਹੜਾ ਆਮ ਜਨਤਾ ਨੂੰ ਕੋਈ ਸਾਹ ਲੈਣ 'ਚ ਤਕਲੀਫ਼ ਨਾ ਹੋਵੇ ਔਰ ਫਾਇਦਾ ਜ਼ਿਆਦਾ ਹੈਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਓਕੇ ਜੀ ਓਕੇ ਓਕੇ ਜੀ ਓਕੇ ਓਕੇ ਓਕੇ